ਸਤਿ ਸ਼੍ਰੀ ਅਕਾਲ ਸਰ

ਹਾਂਜੀ ਜ਼ਰੂਰ ਸਾਡੇ ਕੋਲ ਬਹੁਤ ਵਧੀਆ ਆਈਡੀਆਸ ਨੇ ਕ੍ਰਿਏਟਿਵ ਆਈਡੀਆਸ ਹਾਂਜੀ ਕਰਦੇ ਹਾਂ ਹੋਰ ਤੁਸੀਂ ਇਹ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਕਰਨਾ ਚਾਹ ਰਹੇ ਓ ਅੱਛਾ ਸ਼ੇਅਰ ਮਾਰਕੀਟ 'ਚ ਤਾਂ ਇਸ ਲਈ ਆਪਾਂ ਨੂੰ ਇੱਕ ਬ੍ਰੋਕਰ ਹਾਇਰ ਕਰਨਾ ਪੈਂਦਾ ਆ ਬ੍ਰੋਕਰ ਦਾ ਮਤਲਬ ਹੁੰਦਾ ਹੈ ਕਿ ਇੱਕ ਮਿਡਲ ਮੈਨ ਮਤਲਬ ਇੱਕ ਬੰਦਾ ਆਪਾਂ ਉਹਨੂੰ ਕਹਿੰਦੇ ਹਾਂ ਵੀ ਅਸੀਂ ਕੁਛ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਨਾ ਅਤੇ ਫਿਰ ਉਹ ਆਪਾਂ ਉਹ ਅੱਗੇ ਫਿਰ ਇੱਕ ਕੰਪਨੀ ਹੈ ਜਿਸ ਦਾ ਨਾਮ ਜੇ ਬੀ ਹੈ ਅਤੇ ਉਹ ਉਸ ਫਿਰ ਕੰਪਨੀ 'ਚ ਜਾ ਕੇ ਸ਼ੇਅਰਸ ਇਸ਼ੂ ਕਰਵਾਉਂਦਾ ਫਿਰ ਉਹ ਆਪਾਂ ਨੂੰ ਦੱਸਦਾ ਕਿ ਤੁਸੀਂ ਇੰਨੀ ਤੁਹਾਡੀ ਸ਼ੇਅਰ ਮਾਰਕੀਟ 'ਚ ਇੰਨੀ ਇਨਵੈਸਟਮੈਂਟ ਹੋ ਚੁੱਕੀ ਹੈ ਅਤੇ ਜਿਹੜਾ ਆਪਾਂ ਡੀ ਉਹ ਫਿਰ ਜਿਹੜਾ ਬ੍ਰੋਕਰ ਹੈ ਉਹ ਆਪਣਾ ਪਹਿਲਾਂ ਡੀਮਟ ਅਕਾਊਂਟ ਮਤਲਬ ਡੀਮੈਂਟ ਅਕਾਊਂਟ ਇੱਕ ਅ ਮਨੀ ਦੀ ਇਲੈਕਟ੍ਰਾਨਿਕ ਫੋਮ ਆ ਮਤਲਬ ਉਹਨੂੰ ਆਪਾਂ ਕੋਈ ਚੋਰੀ ਨਹੀਂ ਕਰ ਸਕਦਾ ਕੋਈ ਠਾਕੀ ਵੀ ਨਹੀਂ ਹੋ ਸਕਦੀ ਕੋਈ ਚੋਰੀ ਵੀ ਨਹੀਂ ਕਰ ਸਕਦਾ ਕੋਈ ਧੋਖਾ ਵੀ ਨਹੀਂ ਕਰ ਸਕਦਾ ਆਪਣੇ ਨਾਲ ਕਿਉਂਕਿ ਅ ਜਿਹੜਾ ਡੀਮਟ ਅਕਾਊਂਟ ਆ ਉਹ ਇਲੈਕਟ੍ਰਾਨਿਕ ਫੋਮ ਹੈ ਅਤੇ ਉਹਦੇ ਕੁਛ ਡੀਮਟ ਅਕਾਊਂਟ ਨੂੰ ਖੋਲ੍ਹਣ ਦੇ ਵੀ ਕੁਝ ਆਪਣੇ ਕੋਲ ਸਟੈਪਸ ਹੁੰਦੇ ਨੇ

ਹਾਂਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਪਹਿਲਾਂ ਆਪਾਂ ਨੂੰ ਇੱਕ ਬ ਬ੍ਰੋਕਰ ਹਾਇਰ ਕਰਨਾ ਪੈਂਦਾ ਉਹਨੂੰ ਵੀ ਆਪਾਂ ਚੁਣ ਕੇ ਹਾਇਰ ਕਰਦੇ ਹਾਂ ਕਿਉਂਕਿ ਜਿਹੜੇ ਕਈ ਬ੍ਰੋਕਰਸ ਹੁੰਦੇ ਨੇ ਉਹ ਆਪਣਾ ਫਾਇਦਾ ਕਮਾਉਣ ਲਈ ਆਪਾਂ ਨੂੰ ਫਿਰ ਨੁਕਸਾਨ ਆਪਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਨੇ ਆਪਣੇ ਕੋਲ ਉਹ ਆਪਣੇ ਕੋਲ ਪ੍ਰੋਫਿਟ ਰੱਖ ਲੈਂਦੇ ਨੇ ਇਸ ਲਈ ਆਪਾਂ ਨੂੰ ਐਨਾਲਾਈਜ਼ ਕਰਨਾ ਪੈਂਦਾ ਕਿ ਕਿਹੜਾ ਬ੍ਰੋਕਰ ਆਪਾਂ ਨੂੰ ਹਾਇਰ ਕਰਨਾ ਚਾਹੀਦਾ ਫਿਰ ਉਸ ਤੋਂ ਬਾਅਦ ਜਿਹੜਾ ਬ੍ਰੋਕਰ ਹੁੰਦਾ ਹੈ ਨਾ ਉਹ ਪ੍ਰਾਈਜ਼ ਐਨਾਲਾਈਜ਼ ਕਰਦਾ ਕਿ ਮਾਰਕੀਟ ਵਿੱਚ ਸ਼ੇਅਰਸ ਦੇ ਕਿੰਨੀ ਡਿੱਗ ਰਿਹਾ ਸ਼ੇਅਰ ਕਿ ਅੱਪ ਹੋ ਰਹੇ ਆ ਕਿ ਆਏ ਉਹ ਐਨਾਲਾਈਜ਼ ਕਰਦਾ ਕਿ ਉਹ ਪ੍ਰਾਈਜ਼ ਕੀ ਹੈ ਸ਼ੇਅਰਸ ਦਾ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਜਿਹੜਾ ਆਪਾਂ ਬ੍ਰੋਕਰ ਹਾਇਰ ਕੀਤਾ ਸੀਗਾ ਨਾ ਉਹ ਕੀ ਕਰਦਾ ਉਹ ਕੀ ਕਰਦਾ ਕੀ ਉਹ ਨਾ ਓਡਰ ਸਿਰਫ਼ ਓਡਰ ਪਲੇਸ ਕਰਦਾ ਕਿਉਂਕਿ ਜੇ ਸੀ ਬੀ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਆਪਾਂ ਆਪਾਂ ਨੂੰ ਅਪੋਆਇੰਟਮੈਂਟ ਲੈ ਕੇ ਜਾਣਾ ਪੈਂਦਾ ਉਹ ਫ੍ਰੀ ਵੀ ਨਹੀਂ ਹੁੰਦੇ ਨਾ ਇਸ ਲਈ ਜਿਹੜਾ ਬ੍ਰੋਕਰ ਹੈ ਫਿਰ ਉਹ ਓਡਰ ਪਲੇਸ ਕਰਦਾ ਫਿਰ ਓਡਰ ਪਲੇਸ ਕਰਨ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਬ੍ਰੋਕਰ ਹੈ ਫਿਰ ਉਹ ਉਹ 'ਚ ਕਮਿਊਨੀਕੇਸ਼ਨ ਹੁੰਦੇ ਆ ਕਮਿਊਨੀਕੇਸ਼ਨ ਦੇ ਵੀ ਬੜੇ ਸਟੈਪਸ ਹੁੰਦੇ ਜਿਵੇਂ ਕਿ ਇਨਕੋਡਿੰਗ ਡੀਕੋਡਿੰਗ ਇਸ ਤਰ੍ਹਾਂ ਦੇ ਇਸ ਲਈ ਉਹ ਫਿਰ ਕਮਿਊਨੀਕੇਸ਼ਨ ਸਕਿੱਲਸ ਵੀ ਉਹਦੇ ਕੋਲ ਬਹੁਤ ਵਧੀਆ ਹੁੰਦੀਆਂ ਨੇ ਨਾਲ ਉਹ ਉਹ ਜਿਹੜਾ ਸਹੀ ਬ੍ਰੋਕਰ ਹੁੰਦਾ ਉਹ ਆਪਾਂ ਨੂੰ ਫਿਰ ਘਾਟੇ ਵਿੱਚ ਨਹੀਂ ਜਾਣ ਦਿੰਦਾ ਅਤੇ ਉਹ ਸੇਬੀ ਤੋਂ ਅ ਸ਼ੇਅਰ ਇਸ਼ੂ ਕਰਵਾ ਕੇ ਫਿਰ ਆਪਾਂ ਨੂੰ ਦੱਸ ਦਿੰਦਾ ਕਿ ਤੁਹਾਡੀ ਇੰਨੀ ਇਨਵੈਸਟਮੈਂਟ ਹੋ ਗਈ ਸ਼ੇਅਰਸ ਦੀ ਤੁਹਾਡੇ ਕੋਲ ਇੰਨੇ ਸ਼ੇਅਰਸ ਨੇ ਅਤੇ ਆਪਾਂ ਉਸ ਆਪਣੇ ਇੰਡੀਆ 'ਚ ਉਹੀ ਇੱਕ ਇਕੱਲੀ ਕੰਪਨੀ ਆ ਆਈ ਥਿੰਕ ਕਿ ਜਿਹੜੀ ਇਹ ਸ਼ੇਅਰਸ ਜਾਂ ਡਿਬੈਂਚਰਸ ਇਸ਼ੂ ਕਰਦੀ ਆ ਕੀ ਕੀ ਤੁਹਾਡੇ ਲਈ ਇੰਨੀ ਇਨਫੋਰਮੇਸ਼ਨ ਵ ਅ ਸਹੀ ਕਿ ਹੋਰ ਚਾਹੀਦੀ ਆ ਹੋਰ ਇਨਫੋਰਮੇਸ਼ਨ ਚਾਹੀਦੀ ਐ ਠੀਕ ਹੈ ਜਿਹੜਾ ਡੀਮੈਟ ਅਕਾਊਂਟ ਹੁੰਦਾ ਹੈ ਉਹਦੇ ਨਾਲ ਜਿਹੜਾ ਬ੍ਰੋਕਰ ਹੈ ਉਹੋ ਜਿਹੜਾ ਆਪਾਂ ਬ੍ਰੋਕਰ ਹਾਇਰ ਕਰਦੇ ਹਾਂ ਨਾ ਉਹ ਸੇਬੀ ਤੋਂ ਫਿਰ ਅ ਜਿਹੜੇ ਸ਼ੇਅਰਸ ਇਸ਼ੂ ਕਰਵਾਉਂਦਾ ਹੈ ਨਾ ਫਿਰ ਜ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਜਿਹੜਾ ਮਾਰਕੀਟ ਆ ਉਹ ਬਹੁਤ ਫਿਊਚਰ ਆਪਣਾ ਅੰਨਸਰਟੇਨ ਆ ਕਿ ਫਿਊਚਰ 'ਚ ਜਿਹੜੇ ਸ਼ੇਅਰਸ ਨੇ ਉਹ ਘੱਟ ਵੀ ਸਕਦੇ ਨੇ ਉਹ ਡਿੱਗ ਵੀ ਸਕਦੇ ਨੇ ਉਹ ਵੱਧ ਵੀ ਸਕਦੇ ਨੇ ਅਤੇ ਫਿਰ ਇਸ ਇਸ ਫਿਊਚਰ ਨੂੰ ਆਪਾਂ ਨੂੰ ਪਹਿਲਾਂ ਪਲੈਨ ਕਰਨਾ ਕੀ ਇਹ ਫਿਊਚਰ 'ਚ ਸ਼ੇਅਰਸ ਵਧਣਗੇ ਘਟਣਗੇ ਕੀ ਸ਼ੇਅਰਸ ਵਧਣਗੇ ਕਿ ਘਟਣਗੇ ਕੀ ਇਹ ਕੌਂਸਟੇਂਟ ਰਹਿਣਗੇ ਕੀ ਇਹ ਸਥਿਰ ਰਹਿਣਗੇ ਇਸ ਲਈ ਪਹਿਲਾਂ ਆਪਾਂ ਨੂੰ ਪਲੈਨਿੰਗ ਕਰਨੀ ਪੈਂਦੀ ਫਿਰ ਆਪਾਂ ਨੂੰ ਓਰਗਨਾਇਜ਼ ਕਰਨਾ ਪੈਂਦਾ ਹੈ ਕਿ ਆਪਾਂ ਨੂੰ ਦੇਖਣਾ ਪੈਂਦਾ ਕਿ ਆਪਾਂ ਜਿਹੜੀ ਜਿਹੜਾ ਕੁਛ ਅ ਆਪਾਂ ਪਲੈਨ ਕੀਤਾ ਸੀਗਾ ਉਹ ਸਹੀ ਚੱਲ ਰਿਹਾ ਕਿ ਉਹ 'ਚ ਕੋਈ ਗੜਬੜ ਹੋ ਰਹੀ ਹੈ ਫਿਰ ਪਲੈਨ ਕਰਨ ਤੋਂ ਬਾਅਦ ਆਪਾਂ ਕੀ ਕਰਦੇ ਹਾਂ ਜੋ ਆਪਾਂ ਪਲੈਨ ਕੀਤਾ ਹੁੰਦਾ ਉਹਨੂੰ ਪਹਿਲਾਂ ਸਹੀ ਤਰੀਕੇ ਨਾਲ ਓਰਗਨਾਇਜ਼ ਕਰ ਲੈਂਦੇ ਹਾਂ ਫਿਰ ਆਪਾਂ ਕੀ ਕਰਦੇ ਹਾਂ ਫਿਰ ਆਪਾਂ ਦੇਖ ਰੇਖ ਕਰਦੇ ਹਾਂ ਕਿ ਜਿਹੜਾ ਆਪਾਂ ਓਰਗਨਾਇਜ਼ ਕੰਮ ਕੀਤਾ ਹੋਇਆ ਸੀਗਾ ਉਹ ਸਹੀ ਤਰ੍ਹਾਂ ਚੱਲ ਰਿਹਾ ਕਿ ਉਹ 'ਚ ਕੋਈ ਗੜਬੜ ਹੋ ਰਹੀ ਹੈ ਉਹ 'ਚ ਕੋਈ ਜਿਹੜਾ ਆਪਣਾ ਬ੍ਰੋਕਰ ਹਾਇਰ ਕੀਤਾ ਉਹ ਕੋਈ ਗੜਬੜ ਤਾਂ ਨਹੀਂ ਕਰ ਰਿਹਾ ਕੋਈ ਆਪਣਾ ਪ੍ਰੋਫਿਟ ਤਾਂ ਨਹੀਂ ਜ਼ਿਆਦਾ ਕਮਾ ਰਿਹਾ ਅਤੇ ਆਪਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਕਰ ਰਿਹਾ ਇਸ ਲਈ ਉਸ ਤੋਂ ਬਾਅਦ ਕੀ ਹੁੰਦਾ ਅਪ ਹਾਂਜੀ ਥੈਂਕਿਊ ਹਾਂਜੀ ਓਕੇ ਓਕੇ